ਹਾਂਜੀ ਅਸੀਂ ਯਾਤਰਾ ਕੀਤੀ ਹੈ ਉ ਔਰ ਉੱਥੇ ਅਸੀਂ ਬਹੁਤ ਹੀ ਵਧੀਆ ਤਸਵੀਰਾਂ ਲਈਆਂ ਮੈਂ ਆਪਣੇ ਫਰੈਂਡ ਨਾਲ ਆਪਣੇ ਫੈਮਲੀਜ਼ ਨਾਲ ਐਕਚੁਲੀ ਮੈਨੂੰ ਟਰਿਪ ਬਹੁਤ ਹੀ ਪਸੰਦ ਹੈ ਮੈਂ ਟਰਿਪ ਜਾਣਾ ਬਹੁਤ ਪਸੰਦ ਕਰਦੀ ਹੈ ਮੇਰੀ ਫੈਮਲੀ ਨੂੰ ਵੀ ਘੁੰਮਣ ਫਿਰਨ ਦਾ ਬਹੁਤ ਹੀ ਸ਼ੌਂਕ ਹੈ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਅਸੀਂ ਬਹੁਤ ਸਾਰੀਆਂ ਤਸਵੀਰਾਂ ਹੀ ਲੈਂਦੇ ਹਾਂ ਤੋ ਤੁਹਾਨੂੰ ਵੀ ਪਤਾ ਹੈ ਕਿ ਜੋ ਤਸਵੀਰਾਂ ਹੁੰਦੀਆਂ ਨੇ ਉਹ ਬਹੁਤ ਲੋਂਗ ਟਾਈਮ ਲਈ ਇੱਕ ਯਾਦ ਇੱਕ ਪਰੋਈ ਜਾਂਦੀ ਹੁੰਦੀ ਆ ਹੈ ਨਾ ਆਪਣੀ ਉਸ ਦੇ ਅਕਾਡਿੰਗ ਆਪਾਂ ਇੱਕ ਜੋ ਵਧੀਆ ਹੈ ਨਾ ਪ੍ਰੋਫੈਸ਼ਨਲੀ ਇੱਕ ਪਿਚਰ ਲਈ ਸੀ ਔਰ ਉਹ ਬਹੁਤ ਹੀ ਸੁੰਦਰ ਸੀ ਮੇਰੀ ਫੈਮਿਲੀ ਅਤੇ ਮੇਰੀ ਮੇਰੀ ਪਰਿਵਾਰ ਨੂੰ ਵੀ ਉਹ ਫੋਟੋ ਬਹੁਤ ਹੀ ਪਸੰਦ ਸੀ ਅਤੇ ਮੈਂ ਉਹ ਤਸਵੀਰ ਅਸੀਂ ਸਭ ਤੋਂ ਵਧੀਆ ਲਈ ਸੀ ਅਸੀਂ ਇੱਕ ਸ਼ਿਮਲੇ ਦਾ ਟਰਿਪ ਬਣਾਇਆ ਸੀ ਫੈਮਲੀ ਦੇ ਅਕਾਰਡਿੰਗ ਉੱਥੇ ਅਸੀਂ ਬਹੁਤ ਹੀ ਤਸਵੀਰਾਂ ਲਈਆਂ ਜੋ ਕਿ ਬਹੁਤ ਹੀ ਉੱਥੇ ਸੁੰਦਰ ਜਗ੍ਹਾ ਸੀਗੀ ਉੱਥੋਂ ਹੀ ਲਈਆਂ ਗਈਆਂ ਸੀਗੀਆਂ ਤਸਵੀਰਾਂ ਦੀ ਖੂਬਸੂਰਤੀ ਤੁਹਾਨੂੰ ਵੀ ਪਤਾ ਜਦੋਂ ਬਾਹਰ ਆਪਾਂ ਜਾਂਦੇ ਹਾਂ ਆਪਾਂ ਬਾਹਰ ਇੱਕ ਪਰਸਨਲ ਆਪਣੀ ਯਾਦ ਪਰੋਣ ਲਈ ਇੱਕ ਫੋਟੋ ਕਲਿੱਕ ਕਰਦਾ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਹੈ ਜੋ ਕਿ ਆਪਣੇ ਨਾਲ ਹਮੇਸ਼ਾ ਹੀ ਰਹਿੰਦੀ ਹੈ ਤਸਵੀਰਾਂ ਹਰ ਇੱਕ ਇਨਸਾਨ ਨੂੰ ਲੈਣੀਆਂ ਚਾਹੀਦੀਆਂ ਨੇ ਹਰ ਇੱਕ ਦੀ ਜ਼ਿੰਦਗੀ ਦਾ ਇੱਕ ਸ਼ਪੈਸ਼ਲ ਮੂਮੈਂਟ ਹੁੰਦੀ ਆ ਆਪਾਂ ਹਰ ਇੱਕ ਪਰਸਨ ਲੈਂਦਾ